ਘਰ ਵਿੱਚ ਕੰਮ ਕਰਦੇ ਸਮੇਂ ਟੈਲੀਵਿਜ਼ਨ ਅੋਨ ਰਹਿੰਦਾ ਹੈ ਅਤੇ ਉਸ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਚਲਦਾ ਰਹਿੰਦਾ ਹੈ ਮੋਬਾਇਲ 'ਤੇ ਵੀ ਮਿਊਜ਼ਿਕ ਚਲਦਾ ਰਹਿੰਦਾ ਹੈ ਕੰਮ ਕਰਦੇ ਸਮੇਂ ਰਿਸ਼ਤੇਦਾਰਾਂ ਨਾਲ ਮੋਬਾਇਲ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਨਾਲ ਹੀ ਕੰਮ ਵੀ ਹੁੰਦਾ ਰਹਿੰਦਾ ਹੈ ਅੱਜ ਕੱਲ੍ਹ ਵੀਡਿਓ ਕੋਲ ਦਾ ਵੀ ਰਿਵਾਜ਼ ਚੱਲ ਪਿਆ ਹੈ ਤਾਂ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਵੀਡਿਓ ਕੋਲ ਵੀ ਕਰ ਸਕਦੇ ਹਾਂ ਆਪਸ ਵਿੱਚ ਵੀ ਕੋਈ ਨਾ ਕੋਈ ਕਰੰਟ ਟੋਪਿਕ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ ਹਨ